ਖੂਹ ਵਿੱਚੋਂ ਪਹਿਲੇ ਸਮਿਆਂ ਦੇ ਵਿੱਚ ਖੂਹ ਵਿੱਚੋਂ ਪਾਣੀ ਕੱਢਣ ਦੇ ਅਲੱਗ ਅਲੱਗ ਤਰੀਕੇ ਹੁੰਦੇ ਸਨ ਜਿਵੇਂ ਕਿ ਪਹਿਲੇ ਸਮਿਆਂ ਦੇ ਵਿੱਚ ਪਾਣੀ ਬਹੁਤ ਉੱਚਾ ਹੁੰਦਾ ਸੀ ਥੋੜ੍ਹਾ ਜਿਹਾ ਟੋਆ ਪੱਟਦੇ ਸੀ ਸੇਮ ਹੁੰਦੀ ਸੀ ਸੇਮ ਦੇ ਵਿੱਚੋਂ ਉਂਗਲਾਂ ਸੌਰੀ ਬਾਲਟੀਆਂ ਭਰ ਭਰ ਕੇ ਬਾਹਰ ਕੱਢਦੇ ਸੀ ਬਾਲਟੀਆਂ ਦੇ ਨਾਲ਼ ਫਿਰ ਉਸ ਤੋਂ ਬਾਅਦ ਕੁਛ ਸਮਾਂ ਬੀਤਦਾ ਗਿਆ ਜਿਉਂ ਜਿਉਂ ਸਮਾਂ ਬੀਤਦਾ ਗਿਆ ਤਿਉਂ ਤਿਉਂ ਪਾਣੀ ਨੀਚੇ ਜਾਣਾ ਸ਼ੁਰੂ ਹੋ ਗਿਆ ਕਿਉਂ ਪਾਣੀ ਦੀ ਖਪਤ ਜ਼ਿਆਦਾ ਸ਼ੁਰੂ ਹੋ ਗਈ ਜਦੋਂ ਪਾਣੀ ਦੀ ਖਪਤ ਜ਼ਿਆਦਾ ਸ਼ੁਰੂ ਹੋ ਗਈ ਤਾਂ ਪਾਣੀ ਵੀ ਨੀਚੇ ਜਾਣਾ ਸ਼ੁਰੂ ਹੋ ਗਿਆ ਅਤੇ ਫੇਰ ਉਸ ਤੋਂ ਬਾਅਦ ਜਨਤਾ ਨੇ ਲੋਕਾਂ ਨੇ ਉਸ ਨੂੰ ਖੂਹ ਦੇ ਰੂਪ ਵਿੱਚ ਬਣਾ ਲਿਆ ਫੇਰ ਖੂਹ ਦੇ ਵਿੱਚ ਬਾਲਟੀ ਅਤੇ ਲੱਜ ਦੀ ਵਰਤੋਂ ਕਰਨ ਲੱਗ ਗਏ ਲੱਜ ਤੋਂ ਬਾਅਦ ਫੇਰ ਜਦੋਂ ਹੋਰ ਵੀ ਡੂੰਘਾ ਚਲਿਆ ਗਿਆ ਤਾਂ ਖੇਤਾਂ ਨੂੰ ਜਿਹੜਾ ਪਾਣੀ ਲਗਾਇਆ ਜਾਂਦਾ ਸੀ ਉਹ ਹਲਟ ਦੇ ਥਰੂ ਪਾਣੀ ਲਗਾਉਂਦੇ ਸਨ ਜਿਹਨੂੰ ਕਿ ਬਲਦਾਂ ਦੀ ਮਦਦ ਲਏ ਲਈ ਜਾਂਦੀ ਥੀ ਪਰ ਉਸ ਤੋਂ ਬਾਅਦ ਫੇਰ ਪਾਣੀ ਕਾਫ਼ੀ ਡੂੰਘਾ ਚਲਿਆ ਗਿਆ ਪਹਿਲੇ ਸੌ ਫੁੱਟ ਦਸ ਫੁੱਟ ਵੀਹ ਪੱਚੀ ਫੁੱਟ 'ਤੇ ਪਾਣੀ ਜਾਂਦਾ ਸੀ ਫਿਰ ਤੀਹ ਪੈਂਤੀ 'ਤੇ ਆ ਗਿਆ ਫਿਰ ਚਾਲੀ ਪੰਤਾਲੀ 'ਤੇ ਆ ਗਿਆ ਫੇਰ ਸੱਠ 'ਤੇ ਫੇਰ ਨੱਬੇ 'ਤੇ ਜਿਉਂ ਜਿਉਂ ਸਮਾਂ ਬੀਤਦਾ ਗਿਆ ਤਿਉਂ ਤਿਉਂ ਪਾਣੀ ਦਾ ਜਿਹੜਾ ਡੂੰਘਾਈ ਚਲੀ ਗਈ ਜਿਉਂ ਜਿਉਂ ਡੂੰਘਾਈ ਗਈ ਤਾਂ ਉੱਥੇ ਫਿਰ ਲੱਜ ਲੱਜ ਬਾਲਟੀ ਜਾਂ ਬੋਲਦ ਵਾਲੀਆਂ ਟਿੰਡਾਂ ਵਾਲਾ ਖੂਹ ਇਹ ਬਹੁਤ ਮੁਸ਼ਕਿਲ ਹੋ ਗਿਆ ਸੀ ਫੇਰ ਉਸ ਤੋਂ ਬਾਅਦ ਇਲੈਕਟ੍ਰੋਨਿਕ ਮੋਟਰਾਂ ਦੀ ਵਰਤੋਂ ਕੀਤੀ ਗਈ ਜਿਹਨੂੰ ਕਿ ਅੱਜ ਕੱਲ੍ਹ ਸਬਮਰਸੀਬਲ ਮੋਟਰ ਕਿਹਾ ਜਾਂਦਾ ਹੈ